ਜੇਕਰ ਅਸੀਂ ਗੱਲ ਕਰੀਏ ਕਿ ਗਾਇਕਾਂ ਦੀਆਂ ਕੁਝ ਗਲਤੀਆਂ ਜੋ ਕਿ ਉਹ ਆਮ ਕਰਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਵਿੱਚ ਕੁਝ ਗਲਤੀਆਂ ਸ਼ਾਮਿਲ ਹਨ ਸੁਰ ਅਤੇ ਤਾਲ ਤੋਂ ਬਾਹਰ ਗਾਉਣਾ ਸਾਹ ਲੈਣ 'ਤੇ ਕਾਬੂ ਨਾ ਰੱਖਣਾ ਅਤੇ ਗੀਤਾਂ ਨੂੰ ਸਹੀ ਢੰਗ ਨਾਲ ਪੇਸ਼ ਨਾ ਕਰਨਾ ਇਹਨਾਂ ਗਲਤੀਆਂ ਤੋਂ ਬਚਣ ਲਈ ਗਾਇਕਾਂ ਨੂੰ ਨਿਯਮਤ ਤੌਰ 'ਤੇ ਅਭਿਆਸ ਕਰਨਾ ਚਾਹੀਦਾ ਹੈ ਸਾਹ ਲੈਣ ਦੀਆਂ ਤਕਨੀਕਾਂ 'ਤੇ ਕੰਮ ਕਰਨਾ ਚਾਹੀਦਾ ਹੈ ਅਤੇ ਗੀਤਾਂ ਨੂੰ ਸਮਝਣ 'ਤੇ ਧਿਆਨ ਵੀ ਦੇਣਾ ਚਾਹੀਦਾ ਹੈ ਇਸ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਗਾਇਕਾਂ ਨੂੰ ਆਪਣੇ ਪ੍ਰਦਰਸ਼ਨਾਂ ਨੂੰ ਰਿਕਾਰਡ ਵੀ ਕਰਨਾ ਚਾਹੀਦਾ ਹੈ ਅਤੇ ਉਹਨਾਂ ਕਮੀਆਂ ਨੂੰ ਦੂਰ ਕਰਨ ਵਾਸਤੇ ਅਲੱਗ ਅਲੱਗ ਲੋਕਾਂ ਤੋਂ ਫੀਡਬੈਕ ਲੈਣੀ ਚਾਹੀਦੀ ਹੈ